ਮੈਂ ਬਚਪਨ ਤੋਂ ਹੀ ਚਿੱਤਰਕਾਰੀ ਸ਼ੁਰੂ ਕੀਤੀ ਸੀ ਮੈਨੂੰ ਬਚਪਨ ਤੋਂ ਹੀ ਚਿੱਤਰਕਾਰੀ ਦਾ ਬਹੁਤ ਸ਼ੌਕ ਸੀ ਸਕੂਲ ਵਿੱਚ ਵੀ ਮੈਂ ਬਹੁਤ ਸੁੰਦਰ ਸੁੰਦਰ ਚਿੱਤਰ ਬਣਾਏ ਹਨ ਜੋ ਕਿ ਸਕੂਲ ਦੀ ਐਗਜੀਬਿਸ਼ਨ ਵਿੱਚ ਵੀ ਲੱਗੇ ਹੋਏ ਹਨ ਅਤੇ ਚਿੱਤਰਕਾਰੀ ਵਿੱਚ ਦਿਲਚਸਪੀ ਮੈਨੂੰ ਬਚਪਨ ਤੋਂ ਹੀ ਸੀ ਅਤੇ ਜਦ ਮੈਂ ਇੱਕ ਮਹਾਨ ਚਿੱਤਰਕਾਰ ਐਮ ਐਸ ਹੁਸੈਨ ਨੂੰ ਦੇਖਿਆ ਜਿਨ੍ਹਾਂ ਨੇ ਇੱਕ ਮਾਧੁਰੀ ਦੀਕਸ਼ਿਤ ਜੀ ਦੀ ਬਹੁਤ ਹੀ ਸੁੰਦਰ ਚਿੱਤਰਕਾਰੀ ਕੀਤੀ ਸੀਗੀ ਉਸ ਤੋਂ ਬਾਅਦ ਉਹਨਾਂ ਨੂੰ ਮੈਂ ਫੋਲੋ ਕਰਨਾ ਸਰਾਰਟ ਕਰ ਦਿੱਤਾ ਉਹਨਾਂ ਦੀ ਚਿੱਤਰਕਾਰੀ ਨੂੰ ਹੀ ਦੇਖ ਦੇਖ ਕੇ ਮੈਂ ਆਪਣਾ ਸੁਧਾਰ ਕੀਤਾ ਅਤੇ ਕਲਾ ਵਿੱਚ ਹੋਰ ਨਿਖਾਰ ਲਿਆਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਉਸ ਨਾਲ ਹੀ ਮੇਰੀ ਕਲਾ ਹੋਰ ਸੁਧਰੀ ਅਤੇ ਚਿੱਤਰਕਾਰੀ ਵਿੱਚ ਮੇਰੀ ਇੰਪਰੂਵਮੈਂਟ ਹੋਈ ਅਤੇ ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਬਹੁਤ ਹੀ ਚਿੱਤਰ ਬਣਾ ਚੁੱਕਿਆ ਹਾਂ ਜਿਸ ਵਿੱਚ ਮੈਨੂੰ ਪੈਂਸਿਲ ਸਕੈਚਿੰਗ ਦਾ ਬਹੁਤ ਹੀ ਸ਼ੌਕ ਹੈ ਧੰਨਵਾਦ